ਅਸੀਂ ਸ਼ਿਮਲੇ ਘੁੰਮਣ ਦਾ ਫਰੈਂਡ ਅਤੇ ਆਪਾਂ ਪਲੈਨ ਕਰ ਰਹੇ ਸੀਗੇ ਅਸੀਂ ਔਨਲਾਈਨ ਕੈਬ ਬੁੱਕ ਕਰਾ ਲਈ ਵੀ ਹਾਂ ਵੀ ਆਪਾਂ ਘੁੰਮ ਕੇ ਆਈਏ ਔਨਲਾਈਨ ਕੈਬ ਕਰਾ ਲਈ ਅਤੇ ਕੈਬ ਵਾਲੇ ਨੂੰ ਟਾਈਮ ਦੇ ਦਿੱਤਾ ਬਾਰਾਂ ਵਜੇ ਦੁਪਹਿਰ ਦੇ ਅਤੇ ਉਹਨੂੰ ਅਸੀਂ ਫੋਨ ਕੀਤਾ ਵੀ ਵੀਰੇ ਟਾਈਮ ਨਾਲ ਆਜੀਂ ਉਹ ਕਹਿੰਦਾ ਠੀਕ ਆ ਠੀਕ ਆ ਵੀਰੇ ਕੋਈ ਨਹੀਂ ਆਜੂਗੇ ਅਤੇ ਉਹਨੇ ਸਾਡੇ ਨਾਲ ਕੀ ਕੀਤਾ ਜਦੋਂ ਦਸ ਕੁ ਵਜੇ ਅਸੀਂ ਫੋਨ ਕਰੇ ਉਹਨੂੰ ਘੱਟੋ ਘੱਟ ਉਹਨੂੰ ਬਾਰਾਂ ਵਜੇ ਤੱਕ ਫੋਨ ਕਰੇ ਮੈਂ ਦਸ ਪੰਦਰਾਂ ਫੋਨ ਕੀਤੇ ਉਹਨੇ ਮੇਰਾ ਫੋਨ ਨਹੀਂ ਚੱਕਿਆ ਅਤੇ ਉਹਨੂੰ ਮੈਂ ਵਟਸਐਪ 'ਤੇ ਮੈਸੇਜ ਕੀਤੇ ਵੀਰੇ ਤੂੰ ਆਇਆ ਨਹੀਂ ਆ ਜਾਉ ਅਸੀਂ ਲੇਟ ਹੁੰਦੇ ਹਾਂ ਅਤੇ ਉਹਨੇ ਕੋਈ ਰਿਪਲਾਈ ਨਹੀਂ ਕੀਤਾ ਮੇਰਾ ਕੋਈ ਕੁਛ ਨਹੀਂ ਕੀਤਾ ਮੈਂ ਪੁੱਛਣਾ ਚਾਹ ਰਿਹਾ ਕਿ ਕੈਬ ਵਾਲਿਆ ਦੀ ਇੰਨੀ ਗੰਦੀ ਸਰਵਿਸ ਹੈ ਵੀ ਸਾਡਾ ਸਾਰਾ ਪਲੈਨ ਬਣਿਆ ਵਾ ਇੱਕ ਬੰਦਾ ਖੱਜਲ ਖੁਆਰ ਕੀਤਾ ਘੱਟੋ ਘੱਟ ਚਾਰ ਪੰਜ ਜਣੇ ਖੱਜਲ ਖੁਆਰ ਹੋਏ ਅਸੀਂ ਇੰਨੀ ਗੰਦੀ ਸਰਵਿਸ ਅਸੀਂ ਨਹੀਂ ਇਹ ਕਰਨਾ ਚਾਹੁੰਦੇ ਨਾਂ ਅੱਗੇ ਤੋਂ ਕੈਬ ਕਰਾਉਣੀ ਹੈ ਅਸੀਂ ਜਾਣਾ ਹੀ ਨਹੀਂ